ਪੰਜਾਬ ਵਿੱਚ ਸਾਡੇ ਵਪਾਰਕ ਖੇਤਰ ਵਿੱਚ ਜਿੱਦਾਂ ਕਿ ਕੋਈ ਵੀ ਕੰਪਨੀ ਜਾਂ ਵਪਾਰਕ ਜਿਹੜੀ ਇੰਡਸਟਰੀ ਹੈ ਉਹ ਇੱਕ ਜਿਵੇਂ ਕੈਮੀਕਲ ਵਾਲੀ ਹੈ ਤਾਂ ਉਹ ਇੱਕ ਆਪਣੇ ਇਸ ਨੂੰ ਵਾਤਾਵਰਣ ਸੰਭਾਲਣ ਲਈ ਇੱਕ ਅਲੱਗ ਤੋਂ ਕਮੇਟੀ ਬਣਾਉਂਦੀ ਹੈ ਜਿਸ ਦਾ ਕੰਮ ਹੈ ਕਿ ਜਿਹੜੇ ਕੈਮੀਕਲ ਦੇ ਵਿੱਚ ਜੂਸ ਵਰਤੋਂ ਜਿਹੜੇ ਵੇਸਟ ਹੁੰਦੇ ਆ ਉਹਨਾਂ ਨੂੰ ਇੱਕ ਖੁੱਲ੍ਹੇ ਤਲਾਬ ਵਿੱਚ ਰੱਖ ਕੇ ਉਹਨਾਂ ਨੂੰ ਜਿਹੜੇ ਹੈ ਕਿ ਜਿਹੜਾ ਕੈਮੀਕਲ ਉੱਡਣ ਵਾਲੇ ਉੱਡ ਉੱਡ ਜਾਂਦੇ ਹਨ ਜਿਹੜੇ ਸੂਰਜ ਦੀ ਰੋਸ਼ਨੀ ਨਾਲ ਖਤਮ ਹੋ ਜਾਂਦੇ ਹਨ ਅਤੇ ਬਾਕੀਆਂ ਨੂੰ ਕਿਸੇ ਤਰੀਕੇ ਨਾਲ ਸਾਫ਼ ਕਰਕੇ ਘਰ ਦਾ ਜਿਹੜਾ ਹੈ ਸਹੀ ਤਰੀਕੇ ਕਰਕੇ ਉਹਨਾਂ ਨੂੰ ਵਾਪਸ ਜਿਹੜਾ ਹੈ ਭੇਜਿਆ ਜਾਂਦਾ ਹੈ ਨਹਿਰਾਂ ਦੇ ਵਿੱਚ ਜਿਸ ਨਾਲ ਜਿਹੜਾ ਪੀਣਯੋਗ ਪਾਣੀ ਵੀ ਬਚਿਆ ਰਹੇ ਅਤੇ ਇਹ ਕਮੇਟੀ ਦਿਨ ਹਰ ਮੰਥ ਵਿੱਚ ਮੀਟਿੰਗਾਂ ਤੈਅ ਕਰਦੀ ਹੈ ਜਿਸ ਨਾਲ ਇਹ ਕਰਦੇ ਹਨ ਕਿ ਅਸੀਂ ਜਿਵੇਂ ਕਿਵੇਂ ਅਸੀਂ ਆਪਣੇ

ਰਿਸੋਰਸਾਂ ਨੂੰ ਘੱਟ ਤੋਂ ਘੱਟ ਯੂਜ ਕਰੀਏ ਵਰਤੋਂ ਕਰੀਏ ਜਿਸ ਨਾਲ ਇਹ ਹੈ ਕਿ ਵਾਤਾਵਰਨ ਨੂੰ ਵੀ ਘੱਟ ਨੁਕਸਾਨ ਹੋਵੇ ਅਤੇ ਸਾਡੇ ਲੋਕਾਂ ਦੀ ਜਿਹੜੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ ਇਸ ਤਰ੍ਹਾਂ ਸਰਕਾਰ ਦੁਆਰਾ ਵੀ ਕਈ ਨੀਤੀਆਂ ਬਣਾਈਆਂ ਜ ਗਈਆਂ ਹਨ ਅਤੇ ਕੁਝ ਕੰ ਕੰਪਨੀਆਂ ਜਿਹੜੀਆਂ ਹਨ ਜਿਹੜੀਆਂ ਕਿ ਵੱਧ ਤੋਂ ਵੱਧ ਰੁੱਖ ਲਗਾਉਂਦੀਆਂ ਹਨ ਜਿਸ ਨਾਲ ਵਾਤਾਵਰਨ ਜਿਹੜਾ ਹੈ ਸੁਰੱਖਿਅਤ ਰਹੇ